ਕਲਾ ਜ਼ਾਂ ਸਹਿਤ ਸਮਕਾਲੀ ਜੀਵਨ ਜਾ ਦਾ ਦਰਪਣ ਹੁੰਦਾ ਹੈ ਕਲਾਕਾਰ ਜਾਂ ਸਾਹਿਤਕਾਰ ਆਪਣੇ ਸਮੇਂ ਦੀ ਤਸਵੀਰ ਤੁਲਕ ਜਾਂ ਕਲਮ ਰਾਹੀਂ ਬਿਆਨ ਕਰਦਾ ਹੈ ਸਾਡੇ ਸਮਾਜਿਕ ਜੀਵਨ ਦੀ ਤਸਵੀਰ ਪ੍ਰਚੱਲਿਤ ਰਾਜਨੀਤਿਕ ਢਾਂਚੇ ਵਿੱਚੋਂ ਹੀ ਦੇਖੀ ਜਾ ਸਕਦੀ ਹੈ ਇਸ ਲਈ ਇਹੋ ਜਿਹਾ ਰਾਜਨੀਤਿਕ ਪੱਧਰ ਹੋਵੇਗਾ ਉਹ ਜਿਹਾ ਜੀਵਨ ਕਲਾ ਜਾਂ ਸਾਹਿਤ ਦੀ ਰਚਨਾ ਕਰੇਗਾ ਕਲਾ ਦੀ ਵੱਖ ਵੱਖ ਵਿਦਵਾਨਾਂ ਨੇ ਵੱਖੋ ਵੱਖਰੀ ਪਰਿਭਾਸ਼ਾ ਦਿੱਤੀ ਹੈ ਇਹਨਾਂ ਦਾ ਪ੍ਰਮੋ ਇਹਨਾਂ ਵਿੱਚ ਪ੍ਰਮੁੱਖ ਚਿੱਤਰ ਹਨ ਟਲੋਟੀਨਮ ਰਸਕਿਨ ਟਾਲਸਟਾਏ ਆਦਿ ਸਗੋਂ ਵੱਖੋ ਵੱਖ ਵਿਦਵਾਨ ਕਲਾ ਦੀ ਵੱਖੋ ਵੱਖ ਪਰਿਭਾਸ਼ਾ ਦਿੰਦੇ ਰਹੇ ਹਨ ਅਜੇ ਤੱਕ ਵੀ ਕੋਈ ਸਥਾਈ ਅਤੇ ਨਿਸ਼ਚਿਤ ਪਰਿਭਾਸ਼ਾ ਨਹੀਂ ਮੰਨੀ ਗਈ ਅਗਰ ਕਿਸੇ ਨੇ ਚੰਗਾ ਚੰਗੇ ਕਲਾਕਾਰ ਬਣਨਾ ਹੈ ਤਾਂ ਉਹ ਹੌਲੀ ਹੌਲੀ ਸਟਾਰਟ ਕਰਨਗੇ ਵਿਦ ਦਿਅਰ ਡਰਾਇੰਗਸ ਸ਼ੇਪਸ ਵਗੈਰਾ ਬਣਾ ਕੇ ਉਹ ਸਟਾਰਟ ਕਰ ਸਕਦੇ ਨੇ ਚਿੱਤਰਕਾਰੀ ਸ਼ੁਰੂ ਕਰਨਾ ਹੀ ਬਹੁਤ ਵੱਡੀ ਇੱਕ ਕਲਾ ਹੈ ਅਗਰ ਕੋਈ ਗਲਤ ਚਿੱਤਰ ਬਣਾਉਂਦਾ ਹੈ ਤਾਂ ਕੋਈ ਗੱਲ ਨਹੀਂ ਉਹ ਅੱਗੇ ਅੱਗੇ ਜਾ ਕੇ ਪ੍ਰੈਕਟਿਸ ਕਰਕੇ ਤੇਜ ਬਣ ਸਕਦੇ ਹਾਂ